ਹਾਂਜੀ ਅਗਰ ਤੁਸੀਂ ਵਿਹਲੇ ਟਾਈਮ ਦੀ ਗੱਲ ਕਰਦੇ ਹੋ ਵਿਹਲੇ ਸਮੇਂ ਦੀ ਗੱਲ ਕਰਦੇ ਹੋ ਤਾਂ ਤਕਰੀਬਨ ਮੇਰਾ ਆ ਹੁੰਦਾ ਸੁਭਾਅ ਜਿਵੇਂ ਸ਼ੁਰੂ ਤੋਂ ਹੀ ਬਣਿਆ ਵਾ ਆਪਣੇ ਖੇਤਾਂ ਵਿੱਚ ਚਲੇ ਜਾਂਦਾ ਉੱਥੇ ਜਾ ਕੇ ਖੇਤ ਦੇ ਆਲੇ ਦੁਆਲੇ ਵੱਟ ਵੱਟ ਪਰ ਮੈਂ ਗੇੜੇ ਮਾਰਨੇ ਆ ਗੇੜੇ ਮਾਰਦਾ ਉਸ ਤੋਂ ਬਾਅਦ ਫੇਰ ਜਦ ਸ਼ਾ ਬ ਆਪਣਾ ਸ਼ਾਮ ਨੂੰ ਬੱਚਿਆਂ ਨਾਲ ਮੈਂ ਟਾਈਮ ਸਪੈਂਡ ਜ਼ਰੂਰ ਕਰਦਾ ਬੱਚਿਆਂ ਨਾਲ ਸਮਾਂ ਬਿਤਾਉਣਾ ਮੈਨੂੰ ਬਹੁਤ ਜ਼ਿਆਦਾ ਵਧੀਆ ਲੱਗਦਾ ਔਰ ਕਈ ਵਾਰ ਸ਼ਾਮ ਨੂੰ ਕਈ ਵਾਰ ਅਸੀਂ ਯਾਰ ਦੋਸਤ ਇਕੱਠੇ ਹੋ ਕੇ ਤਾਂਸ਼ ਖੇਡਣ ਲੱਗ ਜਾਂਦੇ ਹਾਂ ਜਾਂ ਕੋਈ ਹੋਰ ਗੇਮ ਇਹ ਜਿਵੇਂ ਸ਼ਾਮ ਨੂੰ ਕਈ ਵਾਰ ਅਸੀਂ ਨਾ ਗਰਾਊਂਡ ਦੇ ਵਿੱਚ ਚਲੇ ਜਾਂਦੇ ਹਾਂ ਤਾਂ ਉੱਥੇ ਅਸੀਂ ਬਾਸਕਿਟਬਾਲ ਜ਼ਰੂਰ ਖੇਡਦੇ ਹਾਂ ਕਿਉਂਕਿ ਉਸ ਨਾਲ ਸਰੀਰ ਨੂੰ ਗਰਮੀ ਆਉਂਦੀ ਆ ਗਰਮੀ ਆਉਣ ਨਾਲ ਸਰੀਰ ਖੁੱਲ੍ਹ ਜਾਂਦਾ ਹੈ ਇੱਕ ਤਾਂ ਜਿੰਮ ਜਾਣ ਦੀ ਲੋੜ ਨਹੀਂ ਹੈ ਉਹਦੇ ਨਾਲ ਔਰ ਸਰੀਰ ਤੰਦਰੁਸਤ ਔਰ ਨਰੋਆ ਉਹਦੇ ਨਾਲ ਭੁੱਖ ਵੀ ਚੰਗੀ ਲੱਗਦੀ ਆ ਕਈ ਵਾਰ ਸ਼ਾਮ ਨੂੰ ਅਸੀਂ ਜਿਵੇਂ ਜ਼ਿਆਦਾ ਖੁਸ਼ੀ ਦਾ ਟਾਈਮ ਹੋਵੇ ਜਾਂ ਕਿਸੇ ਯਾਰ ਦੋਸਤ ਦਾ ਅਸੀਂ ਬਡੇ ਜ਼ਰੂਰ ਜਿਹੜਾ ਜਨਮਦਿਨ ਹੁੰਦਾ ਉਹ ਅਸੀਂ ਜ਼ਰੂਰ ਸਾਰਿਆਂ ਦਾ ਫਿਕਸ ਕੀਤਾ ਵਾ ਜਿਹੜੇ ਤਾਂ ਬੰਦੇ ਉਸ ਦਿਨ ਵੈਸ਼ਨੋ ਹੁੰਦੇ ਆਂ ਉਹਨਾਂ ਨੂੰ ਅਸੀਂ ਵੈਸ਼ਨੂੰ ਖਾਣਾ ਕਰਦੇ ਹਾਂ ਜਿਹੜੇ ਬੰਦੇ ਨੋਨ ਵੈੱਜ ਜਿਵੇਂ ਮੁਰਗਾ ਮਾਸ ਮੱਛੀ ਖਾਣ ਦੇ ਸ਼ੌਕੀਨ ਆ ਉਹਨਾਂ ਵਾਸਤੇ ਅਸੀਂ ਉੱਦਾਂ ਦਾ ਪ੍ਰਬੰਧ ਕਰਦੇ ਹਾਂ ਉਹਦੇ ਨਾਲ ਕੀ ਹੁੰਦਾ ਹੈ ਫੈਮਲੀਆਂ ਜਿਹੜੀਆਂ ਪਰਿਵਾਰ ਆ ਇੱਕ ਦੂਜੇ ਨਾਲ ਸ ਪਿਆਰ ਬਣਿਆ ਰਹਿੰਦਾ ਇੱਕ ਦੂਜੇ ਦੇ ਜਦੋਂ ਆਪਾਂ ਘਰ ਜਾਂਦੇ ਹਾਂ ਨਾ ਤਾਂ ਲੋਕਾਂ ਦੇ ਵਿੱਚ ਇੱਕ ਤਰ੍ਹਾਂ ਨਾਲ ਮੈਸੇਜ ਵਧੀਆ ਜਾਂਦਾ ਵੀ ਹਾਂ ਇਹ ਕਿੰਨਾ ਵਧੀਆ ਪਰਿਵਾਰ ਆ ਹੱਸਦੇ ਦੁਸਦੇ ਆ ਅਤੇ ਨਾਲ ਬੱਚਿਆਂ ਦੇ ਵੀ ਇੰਟਰੋਡਕਸ਼ਨ ਹੋ ਜਾਂਦੀ ਹੈ ਇੱਕ ਦੂਜੇ ਨੂੰ ਉਹ ਜਾਣਨ ਲੱਗ ਜਾਂਦੇ ਆ ਕਿਉਂਕਿ ਬੱਚੇ ਜਿਹੜੇ ਕਿਸੇ ਦਾ ਬੱਚਾ ਕਿਸੇ ਸਕੂਲ 'ਚ ਪੜ੍ਹਦਾ ਕਿਸੇ ਬੱਚੇ ਦਾ ਕਿਸੇ ਸਕੂਲ 'ਚ ਪੜ੍ਹਦਾ ਉਹਦੇ ਨਾਲ ਫੇਰ ਬੱਚਾ ਸਾਡੇ ਪਿਆਰ ਨਾਲ ਬੱਚਿਆਂ ਦਾ ਪਿਆਰ ਵੱਧਦਾ ਤਦ ਜਿਹੜੀ ਜਨਾਨੀਆਂ ਹੁੰਦੀਆਂ ਉਹ ਵੀ ਇੱਕ ਦੂਜੇ ਦਾ ਜਾਣ ਪਛਾਣ ਹੋ ਜਾਂਦੀ ਹੈ